ਗੀਤਾਂ ਦੀ ਰਚਨਾ ਕੋਈ ਵਿਸ਼ੇਸ਼ ਕਵੀ ਜਾਂ ਇਨਸਾਨ ਨਹੀਂ ਕਰਦਾ ਗੀਤਾਂ ਦੀ ਰਚਨਾ ਉਹਦੀ ਭਾਸ਼ਾ ਉਹਦੇ ਵੱਖ ਵੱਖ ਮਾਹੌਲ ਵਿੱਚ ਆਪੇ ਹੀ ਉੱਭਰ ਕੇ ਆ ਜਾਂਦੇ ਹਨ ਸਗੋਂ ਲੋਕਾਂ ਦੇ ਦਿਲਾਂ ਵਿੱਚ ਗੀਤਾਂ ਦਾ ਰੂਪ ਧਾਰ ਕੇ ਫੁੱਟ ਨਿਕਲਦੇ ਹਨ ਇਸ ਕਰਕੇ ਇਸ ਦਾ ਜਨਮ ਮਨੁੱਖੀ ਸੱਭਿਅਤਾ ਦੇ ਨਾਲ ਹੀ ਹੋਇਆ ਹੈ ਅਤੇ ਇਹਨਾਂ ਦਾ ਵਹਿਣ ਨਿਰੰਤਰ ਵਹਿ ਰਿਹਾ ਹੈ ਪੰਜਾਬ ਉਰਦੂ ਅੰਗਰੇਜ਼ੀ ਹੋਰ ਵੀ ਕਈ ਭਾਸ਼ਾ ਵਿੱਚ ਵੱਖ ਵੱਖ ਸ਼ੈਲੀਆਂ ਨਾਲ ਗੀਤ ਗਾਏ ਜਾਂਦੇ ਹਨ ਪੰਜਾਬ ਦੇ ਲੰਬੇ ਸਮੇਂ ਲੋਕ ਗੀਤਾਂ ਦੇ ਵਿੱਚ ਹੀ ਰਹੇ ਹਨ ਪੰਜਾਬ ਦੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਔਰਤਾਂ ਲੰਬੇ ਗਾਉਣ ਗਾਉਣੇ ਗਾਂਉਦੀਆਂ ਹਨ ਇਹ ਪੰਜਾਬ ਦੀ ਔਰਤਾਂ ਦੀ ਤਰਾਸਦੀ ਹੈ ਔਰ ਪੰਜਾਬ ਦੀ ਔਰਤਾਂ ਦੀ ਤਰਾਸਦੀ ਨੂੰ ਬਿਆਨ ਕਰਨ ਵਾਲੇ ਲੋਕ ਗੀਤਾਂ ਜਿੰਨ੍ਹਾਂ ਵਿੱਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਵਿਆਖਿਆ ਨਾਲ ਕੀਤੀ ਜਾਂਦੀ ਹੈ ਇਸ ਤਰ੍ਹਾਂ ਹੀ ਵੱਖ ਵੱਖ ਭਾਸ਼ਾ ਵਿੱਚ ਲੋਕ ਗੀਤ ਤੇ ਅਲੱਗ ਅਲੱਗ ਵੱਖ ਵੱਖ ਰਿਹਾਇਸ਼ਾਂ ਵਿੱਚ ਗੀਤ ਗਾਏ ਜਾਂਦੇ ਹਨ ਜਿਨ੍ਹਾਂ ਦੇ ਮਨੁੱਖ ਦੇ ਅੰਦਰ ਦੇ ਸੰਤਾਪ ਖੁਸ਼ੀ ਜਨਮ ਮ੍ਰਿਤਿਯੂ ਇਹ ਸਭ ਦਾ ਅਲੱਗ ਅਲੱਗ ਵੇਰਵਾ ਦਿੱਤਾ ਜਾਂਦਾ ਹੈ